ਭੋਜਨ ਨਾਲ ਸੰਬੰਧਿਤ ਸਾਡੇ ਕੋਲ ਕਈ ਪਰੰਪਰਾਵਾਂ ਅਤੇ ਅੰਧ ਵਿਸ਼ਵਾਸ ਵੀ ਹਨ ਪਹਿਲਾਂ ਪਰੰਪਰਾਵਾਂ ਦੀ ਗੱਲ ਕਰਾਂ ਤਾਂ ਰੋਟੀ ਬਣਾਉਣ ਸਮੇਂ ਸਿਰ ਢੱਕ ਕੇ ਬਣਾਉਣੀ ਚਾਹੀਦੀ ਹੈ ਤਾਂ ਕਿ ਉਹਦੇ ਵਿੱਚ ਵਾਲ ਵੁਲ ਨਾ ਗਿਰ ਜਾਵੇ ਦੂਜੀ ਗੱਲ ਹੱਥ ਧੋ ਕੇ ਰੋਟੀ ਬਣਾਉਣੀ ਚਾਹੀਦੀ ਹੈ ਗੰਦੇ ਗੰਦੇ ਤਰੀਕੇ ਨਾਲ ਰੋਟੀ ਨਹੀਂ ਬਣਾਉਣੀ ਚਾਹੀਦੀ ਐਨ ਸਾਫ ਸੁਥਰਾ ਬੰਦਾ ਆਪਣਾ ਹੱਥ ਧੋ ਕੇ ਬਣਾਵੇ ਅਤੇ ਰੋਟੀ ਬਣਾਉਣ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਉਸਦੀ ਉਸਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਤਾਂ ਜੋ ਬਰਕਤ ਹੋਵੇ ਰੱਬ ਦਾ ਨਾਮ ਲੈ ਕੇ ਆਪਣਾ ਰੋਟੀ ਬਣਾਓ ਤਾਂ ਕਿ ਸਾਡੇ ਉਹਦੇ ਵਿੱਚ ਬਰਕਤ ਹੋਵੇ ਦੂਜੀ ਗੱਲ ਅੰਧਵਿਸ਼ਵਾਸ ਦੀ ਗੱਲ ਕਰਾਂ ਤਾਂ ਰੋਟੀ ਬਣਾਉਂਦੇ ਸਮੇਂ ਜੇ ਆਟੇ ਦਾ ਪੇੜਾ ਗਿਰ ਜਾਵੇ ਤਾਂ ਅਸੀਂ ਇਹ ਸੋਚਦੇ ਹਨ ਕਿ ਸ ਜਿਵੇਂ ਸਾਡੇ ਘਰ ਅੱਜ ਕੋਈ ਮਹਿਮਾਨ ਆ ਰਿਹਾ ਹੈ ਉਸ ਤੋਂ ਬਾਅਦ ਅਗਰ ਰੋਟੀ ਖਾਣ ਤੋਂ ਪਹਿਲਾਂ ਇਹ ਛਿੱਕ ਮਾਰ ਦੇਵੇ ਕੋਈ ਤਾਂ ਉਸ ਤੋਂ ਬਾਅਦ ਅਸੀਂ ਦਸ ਮਿੰਟ ਰੁਕ ਕੇ ਰੋਟੀ ਖਾਦੇ ਹਾਂ ਅਤੇ ਰੋਟੀ ਨੂੰ ਹਮੇਸ਼ਾ ਚੁੱਪ ਚਾਪ ਖਾਣਾ ਚਾਹੀਦਾ ਹੈ ਤਾਂ ਕਿ ਪ੍ਰਮਾਤਮਾ ਦਾ ਨਾਂ ਲੈ ਕੇ ਹੀ ਖਾਣੀ ਚਾਹੀਦੀ ਹੈ